ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਮੈਂ ਜੀ ਇੱਥੋਂ ਹੀ ਕੀਤੀ ਆ ਬੀ ਏ ਵੀ ਇੱਥੋਂ ਕੀਤੀ ਸੀਗੀ ਹਾਂਜੀ ਐੱਮ ਏ ਵੀ ਇੱਥੋਂ ਕਰੀ ਹੈ ਹਾਂਜੀ ਤੁਸੀਂ ਪੁੱਛੋ ਤੁਹਾਨੂੰ ਕੀ ਕਿਸ ਬਾਰੇ ਜਾਣਕਾਰੀ ਚਾਹੀਦੀ ਓ ਹਾਂਜੀ ਔਰ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੇ ਟੀਚਰ ਬਹੁਤ ਵਧੀਆ ਨੇ ਬਹੁਤ ਵਧੀਆ ਤਰੀਕੇ ਨਾਲ ਪੜਾਉਂਦੇ ਨੇ ਜਿੱਦਾਂ ਆਪਾਂ ਫਰੈਂਡਲੀ ਤੌਰ 'ਤੇ ਪੜ੍ਹਦੇ ਹਾਂ ਉਹ ਤਰ੍ਹਾਂ ਉਸ ਉਸ ਤਰ੍ਹਾਂ ਹੀ ਸਾਨੂੰ ਪੜਾਉਂਦੇ ਨੇ ਉਹ ਤੁਹਾਨੂੰ ਵੀ ਉਸ ਤਰ੍ਹਾਂ ਹੀ ਪੜਾਉਣਗੇ ਅ ਹਾਂਜੀ ਹਾਂਜੀ ਹੋਸਟਲ ਦੀ ਸੁਵਿਧਾ ਹੈਗੀ ਆ ਮਤਲਬ ਉਹ ਕੁੜੀਆਂ ਵਾਸਤੇ ਅਲੱਗ ਹੋਸਟਲ ਹੈ ਮੁੰਡਿਆਂ ਵਾਸਤੇ ਅਲੱਗ ਹੋਸਟਲ ਹੈ ਹਾਂਜੀ ਹੋਸਟਲ ਬਹੁਤ ਵਧੀਆ ਹੈ ਖੁੱਲ੍ਹਾ ਕਮਰਾ ਵਾ ਤੁਹਾਨੂੰ ਉਹਦੇ ਵਿੱਚ ਤੁਹਾਡਾ ਲੋੜੀਂਦਾ ਸਮਾਨ ਵੀ ਤੁਹਾਨੂੰ ਮਿਲੇਗਾ ਹਾਂਜੀ ਜੇ ਤੁਸੀਂ ਆਪਣਾ ਸਮਾਨ ਆਪ ਲਿਆ ਕੇ ਰੱਖਣਾ ਚਾਹੁੰਦੇ ਹੋ ਉਹ ਵੀ ਰੱਖ ਸਕਦੇ ਹੋ ਹਾਂ ਨਹੀਂ ਇੱਕ ਰੂਮ ਦੋ ਜਣੇ ਤਾਂ ਰਹਿ ਹੀ ਸਕਦੇ ਹਾਂਜੀ ਦੋ ਜਾਣੇ ਹੋਣਗੇ ਇੱਕ ਰੂਮ 'ਚ ਹਾਂਜੀ ਹਾਂਜੀ ਨਹੀਂ ਮੈਂ ਤਾਂ ਇੱਥੋਂ ਮੈਂ ਤਾਂ ਹੈ ਨਹੀਂ ਹੁਣ ਇੱਥੇ ਪੜ੍ਹਦੀ ਵੀ ਵੈਸੇ ਜੇ ਤੁਸੀਂ ਮੈਨੂੰ ਮਿਲਣਾ ਅਸੀਂ ਮਿਲਣਾ ਚਾਹੋ ਤਾਂ ਮੈਂ ਇੱਥੇ ਤੁਹਾਨੂੰ ਮਿਲ ਲਵਾਂਗੀ

ਫੀਸ ਇੱਥੇ ਫੀਸ ਇੱਥੇ ਇੰਨੀ ਜ਼ਿਆਦਾ ਨਹੀਂ ਠੀਕ ਹੀ ਆ ਅਤੇ ਹੋਸਟਲ ਵੀ ਬਹੁਤ ਵਧੀਆ ਨੇ ਲਾਈਬ੍ਰੇਰੀ ਵਗੈਰਾ ਸਾਰੀ ਸਹੂਲਤਾਂ ਤੁਹਾਨੂੰ ਇੱਥੇ ਮਿਲਣਗੀਆਂ ਅਤੇ ਤੁਸੀਂ ਹੋਸਟਲ 'ਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਖਾਣਾ ਵੀ ਮਿਲੇਗਾ ਮਤਲਬ ਕਿ ਸੁਬਹਾ ਵੀ ਖਾਣਾ ਮਿਲੇਗਾ ਨਾਸ਼ਤਾ ਵੀ ਮਿਲੇਗਾ ਦੁਪਹਿਰ ਦਾ ਵੀ ਖਾਣਾ ਹੋਵੇਗਾ ਅਤੇ ਸ਼ਾਮ ਨੂੰ ਵੀ ਖਾਣਾ ਰਾਤ ਨੂੰ ਵੀ ਖਾਣਾ ਮਿਲੇਗਾ ਤੁਹਾਨੂੰ ਹਾਂਜੀ ਜੀ ਹਾਂਜੀ ਹੋਟਲ ਵਗੈਰਾ ਸਭ ਤੁਹਾਨੂੰ ਮਿਲ ਜਾਣਗੇ ਜੇ ਜਿਵੇਂ ਤੁਸੀਂ ਬਸ ਇੱਥੋਂ ਬੱਸ ਤੋਂ ਆ ਰਹੇ ਹੋ ਤਾਂ ਤੁਸੀਂ ਲੈਨ ਲੱਗੀ ਹੋਈ ਹੈ ਤਾਂ ਹੋਸ਼ਟਲ ਤੋਂ ਲੈ ਕੇ ਅੱਡੇ 'ਚੋਂ ਲੈਨ ਲੱਗੇਗੀ ਕਾਲਜ ਤੱਕ ਜੇ ਤੁਸੀਂ ਹੋਸਟਲ 'ਚ ਰਹਿਣਾ ਚਾਹੁੰਦੇ ਹੋ ਤਾਂ ਹੋਸਟਲ 'ਚ ਵੀ ਰਹਿ ਸਕਦੇ ਹੋ ਹਾਂਜੀ ਇੱਥੋਂ ਦਾ ਵਾਤਾਵਰਨ ਵੀ ਬਹੁਤ ਠੀਕ ਆ ਨਾ ਜ਼ਿਆਦਾ ਗਰਮੀ ਹੈ ਮੌਸਮ ਦੇ ਹਿਸਾਬ ਨਾਲ ਹਾਂਜੀ ਜਦੋਂ ਤੁਸੀਂ ਆਉਣਾ ਹੋਇਆ ਜਦੋਂ ਤੁਸੀਂ ਆਉਣਾ ਹੋਇਆ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਾਂਗੀ ਤੁਸੀਂ ਮੈਨੂੰ ਕਾਲ ਕਰ ਲਿਓ ਆਪਾਂ ਮਿਲ ਲਵਾਂਗੇ

ਹਾਂਜੀ ਕੋਈ ਨਹੀਂ ਜ਼ਰੂਰ ਜਦੋਂ ਤੁਸੀਂ ਆਉਣਾ ਹੋਇਆ ਹਾਂਜੀ ਹਾਂਜੀ ਠੀਕ ਆ ਕੋਈ ਗੱਲ ਨਹੀਂ